ਨਮਸ਼ਕਾਰ ਮੇਰਾ ਨਾਮ ਸਾਕਸ਼ੀ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜੇਕਰ ਸਾਡੇ ਘਰ ਵਿੱਚ ਕੋਈ ਬਿਮਾਰ ਹੋਵੇ ਤਾਂ ਅਸੀਂ ਭਿੰਨ ਭਿੰਨ ਪਕਵਾਨ ਬਣਾ ਸਕਦੇ ਹਾਂ ਜਿਵੇਂ ਕਿ ਖਿਚੜੀ ਦਲੀਆ ਨਮਕੀਨ ਚੌਲ ਧੋਤੀ ਮੂੰਗੀ ਦਾਲ ਆਦਿ ਇਹ ਸਭ ਪਕਵਾਨ ਜਿਹੜੇ ਹਨ ਇਹਨਾਂ ਰਾਹੀਂ ਅਸੀਂ ਬਿਮਾਰ ਬੰਦੇ ਨੂੰ ਖਾਣਾ ਖਵਾ ਸਕਦੇ ਹਾਂ ਅਤੇ ਜੇਕਰ ਕੋਈ ਖਾਣਾ ਨਾ ਖਾਵੇ ਤਾਂ ਅਸੀਂ ਉਸਨੂੰ ਚਾਹ ਨਾਲ ਰਸ ਨਾਲ ਬ੍ਰੈਡ ਵਗੈਰਾ ਵੀ ਦੇ ਸਕਦੇ ਹਾਂ ਬਿਮਾਰ ਬੰਦੇ ਨੂੰ ਜੇਕਰ ਅਸੀਂ ਧੋਤੀ ਮੂੰਗੀ ਦਾਲ ਅਤੇ ਖਿਚੜੀ ਅਤੇ ਦਲੀਆ ਵਰਗਾ ਇਕਦਮ ਸਾਦਾ ਖਾਣਾ ਖਾਵਾਂਗੇ ਤਾਂ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਵੇਗਾ ਜ਼ਿਆਦਾਤਰ ਮੰਨਿਆ ਜਾਂਦਾ ਹੈ ਜਿਹੜਾ ਸਾਡਾ ਹੋਰ ਖਾਣਾ ਹੁੰਦਾ ਹੈ ਪਕਵਾਨ ਜਿਹੜੇ ਸਾਡੇ ਹੁੰਦੇ ਹਨ ਉਹਨਾਂ ਵਿੱਚ ਕਾਫੀ ਜ਼ਿਆਦਾ ਮਸਾਲੇ ਪਏ ਹੁੰਦੇ ਹਨ ਪਰ ਜੇਕਰ ਕੋਈ ਬਿਮਾਰ ਹੋਵੇ ਤਾਂ ਉਸਨੂੰ ਇਕਦਮ ਸਾਦਾ ਤੋਂ ਸਾਦਾ ਖਾਣਾ ਦੇਣਾ ਚਾਹੀਦਾ ਹੈ ਜਿਹੜਾ ਖਾਣਾ ਮਸਾਲਿਆਂ ਤੋਂ ਰਹਿਤ ਹੁੰਦਾ ਹੈ ਉਹ ਹੀ ਬਿਮਾਰ ਬੰਦੇ ਨੂੰ ਖਾਣਾ ਚਾਹੀਦਾ ਹੈ ਤਾਂ ਕਿ ਉਹ ਜਲਦੀ ਤੋਂ ਜਲਦੀ ਉਹ ਖਾਣਾ ਖਾਏ ਅਤੇ ਠੀਕ ਹੋ ਜਾਵੇ ਜਿਵੇਂ ਕਿ ਸਾਡੇ ਘਰ ਵਿੱਚ ਕਿਸੇ ਨੂੰ ਬੁਖਾਰ ਹੋਵੇ ਤਾਂ ਸਾਨੂੰ ਉਸ ਨੂੰ ਖਿਚੜੀ ਬਣਾ ਕੇ ਦੇਣੀ ਚਾਹੀਦੀ ਹੈ ਜਾਂ ਫਿਰ ਸਾਨੂੰ ਉਸ ਨੂੰ ਪਤਲੇ ਪਤਲੇ ਧੋਤਵੀ ਮੂੰਗੀ ਦਾਲ ਨਾਲ ਚੌਲ ਬਣਾ ਕੇ ਦੇਣੇ ਚਾਹੀਦੇ ਹਨ ਤਾਂ ਕਿ ਉਹ ਇਹ ਸਿੰਪਲ ਤੋਂ ਸਿੰਪਲ ਖਾਣਾ ਖਾਏ ਅਤੇ ਜਲਦੀ ਠੀਕ ਹੋ ਜਾਵੇ ਜਿਹੜੇ ਸਾਡੇ ਬਾਕੀ ਪਕਵਾਨ ਹੁੰਦੇ ਹਨ ਜਿਵੇਂ ਚਨੇ ਭਟੂਰੇ ਰਾਜਮਾਂਹ ਚਾਵਲ ਘੜੀ ਚਾਵਲ ਇਹ ਸਭ ਬਿਮਾਰ ਬੰਦਿਆਂ ਦਾ ਖਾਣਾ ਨਹੀਂ ਇਹ ਸਭ ਇੱਕ ਤੰਦਰੁਸਤ ਬੰਦਾ ਹੀ ਖਾ ਸਕਦਾ ਹੈ ਕਿਉਂਕਿ ਇਹਨਾਂ ਵਿੱਚ ਬਣਾਉਣ ਇਹਨਾਂ ਨੂੰ ਬਣਾਉਣ ਵਿੱਚ ਸਾਨੂੰ ਕਾਫੀ ਸਾਰੇ ਮਸਾਲੇ ਪਾਉਣੇ ਪੈਂਦੇ ਹਨ ਜਿਵੇਂ ਕੜੀ ਵਿੱਚ ਸਾਨੂੰ ਪਕੌੜੇ ਪਾਉਣੇ ਪੈਂਦੇ ਹਨ ਫਰਾਈਡ ਅਤੇ ਸਾਨੂੰ ਛੋਲੇ ਭਟੂਰੇ ਵਿੱਚ ਵੀ ਕਾਫੀ ਜ਼ਿਆਦਾ ਮਾਤਰਾ ਵਿੱਚ ਆਇਲ ਵਿੱਚ ਉਸਨੂੰ ਪਕਾਉਣਾ ਪੈਂਦਾ ਹੈ ਪਰ ਉਹ ਇੱਕ ਬਿਮਾਰ ਬੰਦੇ ਦਾ ਭੋਜਨ ਬਿਲਕੁਲ ਵੀ ਨਹੀਂ ਹੈ ਸਾਨੂੰ ਕਿਸੇ ਬਿਮਾਰ ਬੰਦੇ ਨੂੰ ਇਕਦਮ ਸਾਦਾ ਖਾਣਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਉਸ ਸਾਦੇ ਖਾਣੇ ਨੂੰ ਜਲਦੀ ਤੋਂ ਜਲਦੀ ਖਾਵੇ ਅਤੇ ਉਸਨੂੰ ਖਾ ਕੇ ਜਲਦੀ ਤੋਂ ਜਲਦੀ ਰਿਕਵਰ ਹੋ ਜਾਵੇ ਜਿੰਨਾ ਸਾਦਾ ਖਾਣਾ ਆਪਾਂ ਖਾਵਾਂਗੇ ਉੱਨੀ ਹੀ ਛੇਤੀ ਆਪਾਂ ਰਿਕਵਰ ਹੋਵਾਂਗੇ ਜੇਕਰ ਸਾਡੇ ਘਰ ਵਿੱਚ ਕੋਈ ਹੋਰ ਬਿਮਾਰ ਬੰਦਾ ਆਉਂਦਾ ਹੈ ਤਾਂ ਸਾਨੂੰ ਉਸ ਨੂੰ ਜੇਕਰ ਉਹ ਧੋਤਵੀ ਮੂੰਗੀ ਦਾਲ ਨਹੀਂ ਖਾਂਦਾ ਤਾਂ ਸਾਨੂੰ ਉਸਨੂੰ ਦਲੀਆ ਬਣਾ ਕੇ ਵੀ ਦੇਣਾ ਚਾਹੀਦਾ ਹੈ ਦਲੀਆ ਵੀ ਇੱਕ ਆਮ ਖਾਣਾ ਹੁੰਦਾ ਹੈ ਬਿਮਾਰ ਬੰਦਿਆਂ ਲਈ ਕਿਉਂਕਿ ਦਲੀਆ ਖਾਣ ਨਾਲ ਵੀ ਅਸੀਂ ਜਲਦੀ ਤੋਂ ਜਲਦੀ ਠੀਕ ਹੋ ਸਕਦੇ ਹਾਂ ਉਸ ਵਿੱਚ ਵੀ ਜ਼ਿਆਦਾ ਕੁਝ ਨਹੀਂ ਪੈਂਦਾ ਸਿੰਪਲ ਇੱਕ ਦੁੱਧ ਹੀ ਪੈਂਦਾ ਹੈ ਜੋ ਕਿ ਸਾਨੂੰ ਬਿਲਕੁਲ ਵੀ ਖਰਾਬ ਨਹੀਂ ਲੱਗਦਾ ਜਿੰਨਾ ਅਸੀਂ ਸਾਦਾ ਖਾਣਾ ਖਾਵਾਂਗੇ ਉੱਨੀ ਹੀ ਜਲਦੀ ਆਪਾਂ ਠੀਕ ਹੋਵਾਂਗੇ ਅਤੇ ਆਪਣਾ ਫਿਰ ਤੋਂ ਸੋਹਣਾ ਸੋਹਣਾ ਜੀਵਨ ਖੁਸ਼ੀ ਭਰਿਆ ਸ਼ੁਰੂ ਕਰ ਸਕਾਂਗੇ ਧੰਨਵਾਦ